ਮੈਂ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਹਾਂ ਬਿਲਕੁਲ ਸਾਡੇ ਘਰ ਪਾਣੀ ਦੀ ਸਪਲਾਈ ਆਉਂਦੀ ਹੈ ਸਰਕਾਰ ਵੱਲੋਂ ਜੋ ਕਿ ਦਿਨ ਵਿੱਚ ਦੋ ਵਾਰ ਆਉਂਦੀ ਹੈ ਇੱਕ ਸਵੇਰੇ ਨੋ ਵਜੇ ਤੋਂ ਲੈ ਕੇ ਇਕ ਵਜੇ ਤੱਕ ਫਿਰ ਉਸ ਤੋਂ ਬਾਅਦ ਪੰਜ ਵਜੇ ਤੋਂ ਲੈ ਕੇ ਰਾਤੀ ਨੌਂ ਵਜੇ ਤੱਕ ਪਾਣੀ ਬਿਲਕੁਲ ਸਾਫ ਆਉਂਦਾ ਹੈ ਪਾਣੀ ਦਾ ਪ੍ਰੈਸ਼ਰ ਵੀ ਠੀਕ ਹੁੰਦਾ ਹੈ ਅਸੀਂ ਘਰ ਵਿੱਚ ਮੋਟਰ ਵੀ ਲਵਾਈ ਹੋਈ ਹੈ ਜਿਸ ਨਾਲ ਕਿ ਜਿਹੜਾ ਪਾਣੀ ਸਾਨੂੰ ਟੂਟੀ ਰਾਹੀਂ ਪ੍ਰਾਪਤ ਹੁੰਦਾ ਹੈ ਉਹ ਅਸੀਂ ਆਪਣੀ ਪਾਣੀ ਦੀ ਟੈਂਕੀ ਵਿੱਚ ਪਾ ਸਕੀਏ ਪਾਣੀ ਦੀ ਕੁਝ ਕੋਈ ਜ਼ਿਆਦਾ ਸਮੱਸਿਆ ਨਹੀਂ ਹੈ ਪਰ ਜਦੋਂ ਕਿ ਬਾਰਿਸ਼ ਦਾ ਮੌਸਮ ਹੁੰਦਾ ਹੈ ਉਸ ਟਾਈਮ ਥੋੜ੍ਹਾ ਜਿਹਾ ਪਾਣੀ ਗੰਦਾ ਆਉਂਦਾ ਹੈ ਅਤੇ ਉਸ ਵਿੱਚ ਬਦਬੂ ਵੀ ਆਉਂਦੀ ਹੈ ਉਸ ਟਾਈਮ ਥੋੜ੍ਹਾ ਜਿਹਾ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਸ ਲਈ ਅਸੀਂ ਘਰਾਂ ਵਿੱਚ ਪਾਣੀ ਨੂੰ ਸਾਫ ਕਰਨ ਵਾਲੀ ਮਸ਼ੀਨ ਵੀ ਲਗਵਾਈ ਹੋਈ ਹੈ ਜਿਸ ਨਾਲ ਕਿ ਜਿਹੜਾ ਗੰਦਾ ਪਾਣੀ ਹੈ ਥੋੜ੍ਹਾ ਜਿਹਾ ਸਾਫ ਹੋ ਕੇ ਸਾਨੂੰ ਮਿਲਦਾ ਹੈ ਅਤੇ ਅਸੀਂ ਉਸ ਦੀ ਵਰਤੋਂ ਕਰ ਸਕਦੇ ਹਾਂ ਇਸ ਲਈ ਪਾਣੀ ਦੀ ਸਮੱਸਿਆ ਸਾਨੂੰ ਜ਼ਿਆਦਾ ਨਹੀਂ ਹੈ ਸਭ ਕੁਝ ਠੀਕ ਆ ਰਿਹਾ ਹੈ